ਕੋਵਿਡ ਉੱਨੀ ਮਹਾਂਮਾਰੀ ਜਿਹੜੀ ਕਿ ਬਹੁਤ ਹੀ ਭਿਆਨਕ ਹੋ ਨਿਬੜੀ ਹਰ ਸਮੇਂ ਕਿਸੇ ਵੀ ਪਾਸੇ ਨੂੰ ਬਿਨਾਂ ਮੂੰਹ 'ਤੇ ਮਾਸਕ ਲਾਏ ਤੋਂ ਜਾ ਨਹੀਂ ਸਕਦੇ ਅਤੇ ਇਸ ਨਾਲ ਪਬਲਕ ਨੂੰ ਬਹੁਤ ਹੀ ਤੰਗੀ ਪੇਸ਼ ਆਈ ਕਿਸੇ ਪਾਸੇ ਵੀ ਨਿਕਲਣਾ ਹੋਵੇ ਹਰ ਥਾਂ ਨਾਕੇ ਲੱਗੇ ਹੋਏ ਦੁਕਾਨਾਂ ਬੰਦ ਕਿਸੇ ਵੀ ਚੀਜ਼ ਦੀ ਕੋਈ ਜ਼ਰੂਰਤ ਪੂਰੀ ਹੋਣ ਲਈ ਬੜੀਆਂ ਹੀ ਦਿੱਕਤਾਂ ਆਉਣ ਲੱਗ ਪਈਆਂ ਸੀ ਇਹ ਸਾਰੇ ਹੀ ਇਲਾਕੇ ਵਿੱਚ ਬਜ਼ਾਰ ਤੱਕ ਸਭ ਬੰਦ ਸਨ ਇਸ ਨਾਲ ਗਰੀਬ ਲੋਕਾਂ ਦੀ ਰੋਜੀ ਰੋਟੀ 'ਤੇ ਵੀ ਬੜਾ ਭਾਰੀ ਅਸਰ ਪਿਆ ਕਿਉਂਕਿ ਜਿਨ੍ਹਾਂ ਨੇ ਰੋਜ਼ਾਨਾ ਹੀ ਆਪਣਾ ਉਹੀ ਕਮਾ ਕੇ ਉਹੀ ਖਾਣਾ ਹੁੰਦਾ ਸੀ ਸਭ ਕੰਮ ਠੱਪ ਹੋਣ ਕਰਕੇ ਗਰੀਬ ਜਨਤਾ ਬੜੀ ਹੀ ਦੁਖੀ ਹੋ ਰਹੀ ਸੀ ਪਰ ਫਿਰ ਵੀ ਜੋ ਦਾਨੀ ਲੋਕ ਹੈ ਉਹਨਾਂ ਦਾ ਵੀ ਕੋਈ ਘਾਟਾ ਨਹੀਂ ਹੈ ਥਾਂ ਥਾਂ 'ਤੇ ਗਰੀਬਾਂ ਵਾਸਤੇ ਲੰਗਰ ਰਸਤਾਂ ਪਾਣੀ ਚਾਹ ਦੁੱਧ ਸਭ ਕੁਛ ਜਿਸ ਤਰ੍ਹਾਂ ਦੀ ਵੀ ਸੇਵਾ ਕੋਈ ਕ ਕਰ ਸਕਦਾ ਸੀ ਘਰ ਬਾਰ ਜਾ ਕੇ ਹਰ ਇੱਕ ਨੂੰ ਸਮੇਂ ਸਮੇਂ 'ਤੇ ਸਭ ਚੀਜ਼ਾਂ ਮੁਹੱਈਆ ਕਰਵਾਈਆਂ ਜਾਂਦੀਆਂ ਰਹੀਆਂ ਹਨ ਇੰਨੀ ਭਿਆਨਕ ਮਹਾਂਮਾਰੀ ਹਸਪਤਾਲ ਭਰੇ ਪਏ ਸੀ ਕਿਸੇ ਪਾਸੇ ਵੀ ਕਿਸੇ ਨੂੰ ਬੈੱਡ ਨਹੀਂ ਸੀ ਮਿਲ ਰਹੇ ਹਰ ਇੱਕ ਵਿਅਕਤੀ ਜੋ ਕਿ ਘਰ ਦਾ ਮੈਂਬਰ ਵੀ ਹੁੰਦਾ ਸੀ ਇੱਕ ਦੂਜੇ ਨੂੰ ਹੱਥ ਲਾਉਣ ਤੋਂ ਵੀ ਕਤਰਾਉਂਦਾ ਸੀ ਇਸ ਬਿਮਾਰੀ ਦਾ ਇੰਨਾ ਡਰ ਪੈ ਚੁੱਕਾ ਸੀ ਬਹੁਤ ਸਾਰੀਆਂ ਮੌਤਾਂ ਹੋ ਰਹੀਆਂ ਸਨ ਸਭ ਪਾਸੇ ਹਾਹਾਕਾਰ ਮੱਚੀ ਹੋਈ ਸੀ ਸਰਕਾਰ ਦਾ ਵੀ ਇਲਾਜ ਪੱਖੋਂ ਬੜੇ ਪ੍ਰਬੰਧ ਕੀਤੇ ਗਏ ਸਨ ਪਰ ਫਿਰ ਵੀ ਜਨਤਾ ਜ਼ਿਆਦਾ ਹੋਣ ਕਰਕੇ ਪੂਰੀ ਦੇਖਭਾਲ ਨਹੀਂ ਹੋ ਰਹੀ ਸੀ ਗਰੀਬ ਜਨਤਾ ਕੁਰਲਾ ਕੁਰਲਾ ਕੇ ਮਰ ਰਹੀ ਸੀ ਇਸ ਭਿਆਨਕ ਬਿਮਾਰੀ ਤੋਂ